ਮੈਂ ਪੰਜਾਬ ਵਿੱਚ ਰਹਿੰਦੀ ਹਾਂ ਅਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੀ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ ਮਗਰ ਪੰਜਾਬੀ ਭਾਸ਼ਾ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ ਕਿਉਂਕਿ ਪੰਜਾਬੀ ਭਾਸ਼ਾ ਇਸ ਪੰਜਾਬ ਦੀ ਮਾਤ ਭਾਸ਼ਾ ਹੈ ਪੰਜਾਬੀ ਭਾਸ਼ਾ ਅੱਜ ਦੁਨੀਆਂ ਦੀ ਬਹੁਤ ਵੱਡੀ ਭਾਸ਼ਾਵਾਂ ਦੇ ਵਿੱਚੋਂ ਇੱਕ ਹੈ ਇਹ ਦੂਜੇ ਦੇਸ਼ਾਂ ਵਿੱਚ ਵੀ ਬੋਲੀ ਜਾਂਦੀ ਹੈ ਦੂਜੇ ਦੇਸ਼ਾਂ ਵਿੱਚ ਵੀ ਪੰਜਾਬ ਦੇ ਲੋਕ ਰਹਿੰਦੇ ਹਨ ਅਤੇ ਉੱਥੇ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਵੱਡੇ ਲੈਵਲ 'ਤੇ ਪਹੁੰਚਾਉਣ ਦੇ ਵਿੱਚ ਕੁਝ ਗੀਤਕਾਰਾਂ ਦੀ ਬਹੁਤ ਵੱਡੀ ਯੋਗਦਾਨ ਹੈ ਜਿਵੇਂ ਕਿ ਸਿੱਧੂ ਮੂਸੇਵਾਲੇ ਦਾ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਰੋਲ ਹੈ ਉਸ ਨੇ ਆਪਣੇ ਗੀਤਾਂ ਦੇ ਥਰੂ ਇਸ ਨੂੰ ਵੱਡੇ ਲੈਵਲ 'ਤੇ ਪਹੁੰਚਾਇਆ ਹੈ ਅਤੇ ਪੰਜਾਬੀ ਭਾਸ਼ਾ ਅੱਜ ਦੂਜੀ ਭਾਸ਼ਾਵਾਂ ਦੇ ਨਾਲੋਂ ਹੀ ਬਹੁਤ ਜ਼ਿਆਦਾ ਵਧੀਆ ਹੈ ਪੰਜਾਬੀ ਭਾਸ਼ਾ ਹਿੰਦੀ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਇੱਥੇ ਪਾਈਆਂ ਜਾਂਦੀਆਂ ਹਨ ਮਗਰ ਇਸ ਭਾਸ਼ਾ ਦਾ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਸਾਰੀ ਭਾਸ਼ਾਵਾਂ ਇਕੁਅਲ ਹੀ ਇਮਪੋਰਟੈਂਟ ਹਨ ਸਾਨੂੰ ਨਫ਼ਰਤ ਕਿਸੇ ਨਾਲ ਵੀ ਨਹੀਂ ਕਰਨੀ ਚਾਹੀਦੀ ਦੂਜੀ ਭਾਸ਼ਾਵਾਂ ਵੀ ਇੰਪੋਰਟੈਂਟ ਹੋਣ ਦੇ ਨਾਲ ਨਾਲ ਇਹ ਬਹੁਤ ਜ਼ਿਆਦਾ ਸਿੱਖਾਂ ਅਤੇ ਜੱਟਾਂ ਨੂੰ ਵੀ ਇਸ ਨੂੰ ਵੱਡੀ ਮਾਤਰਾ 'ਤੇ ਪਹੁੰਚਾਇਆ ਜਾਂਦਾ ਹੈ ਇਸ ਲਈ ਮੈਂ ਬਸ ਪੰਜਾਬੀ ਭਾਸ਼ਾ ਦਾ ਇਹ ਕਹਿਣਾ ਚਾਹੂੰਗੀ ਕਿ ਪੰਜਾਬੀ ਭਾਸ਼ਾ ਅੱਜ ਇੱਕ ਮੁੱਖ ਭਾਸ਼ਾ ਹੈ